ਹੈਲੋ ਸਤਿ ਸ਼੍ਰੀ ਅਕਾਲ ਮੈਮ ਬਸ ਠੀਕ ਆ ਮੈਮ ਮੈਮ ਮੈਂ ਦਿੱਲੀ ਮੈਂ ਕੰਚਨ ਮੈਂ ਦਿੱਲੀ ਤੋਂ ਆਈ ਆਂ ਕਿ ਆ ਹਾਂਜੀ ਤਾਂ ਮੈਂ ਨੋਨ ਹਾਂਜੀ ਹਾਂਜੀ ਮੈਡਮ ਠੀਕ ਠਾਕ ਪਹੁੰਚ ਗਏ ਹੋਰ ਠੀਕ ਹੈ ਤੁਸੀਂ ਹਾਂਜੀ ਹਾਂਜੀ ਅਸੀਂ ਇਹ ਪੁੱਛਣਾ ਸੀਗਾ ਕਿ ਇਥੇ ਅੱਛਾ ਖਾਣ ਨੂੰ ਖਾਣਾ ਵਗੈਰਾ ਦਾ ਰੈਸਟੋਰੈਂਟ ਵਗੈਰਾ ਕਿੱਥੇ ਹੈਂ ਵਧੀਆ ਪੰਜਾਬੀ ਖਾਣਾ ਬੱਚਿਆਂ ਲਈ ਫਾਸਟ ਫੂਡ ਹੋ ਗਿਆ ਹਾਂਜੀ ਮੈਡਮ ਇਹ ਬਾਵਰਚੀ ਹੈ ਕਿੱਥੇ ਹਾਂਜੀ ਅੱਛਾ ਜੀ ਉੱਥੇ ਬਹਿਣ ਵਗੈਰਾ ਦਾ ਅਰੇਂਜਮੈਂਟ ਹੈ ਸਿਟਿੰਗ ਅਰੇਂਜਮੈਂਟ ਵਗੈਰਾ ਹੈ ਅੱਛਾ ਜੀ ਠੀਕ ਹੈ ਮੈਮ ਹਾਂਜੀ ਅੱਛਾ ਮੈਮ ਉੱਥੇ ਰੇਟ ਵੀ ਅੱਛਾ ਠੀਕ ਅੱਛਾ ਜੀ ਮੈਮ ਇੱਥੇ ਕੋਈ ਸਟ੍ਰੀਟ ਫੂਡ ਵਗੈਰਾ ਦੀ ਕੋਈ ਹੈ ਵੀ ਜਿੱਥੇ ਬਹੁਤ ਅੱਛਾ ਮਿਲਦਾ ਹੈ ਕਿ ਫੇਮਸ ਹੋਵੇ ਅੱਛਾ ਜੀ ਠੀਕ ਹੈ ਠੀਕ ਹੈ ਮੈਮ ਰੇਟ ਵਗੈਰਾ ਇਹਨਾਂ ਦੇ ਠੀਕ ਹੈ ਠੀਕ ਹੈ

ਠੀਕ ਹੈ ਠੀਕ ਹੈ ਮੈਡਮ ਠੀਕ ਹੈ ਕੋਈ ਮੈਡਮ ਇੱਥੇ ਆਪਣੇ ਰੋਪੜ ਦੇ ਕੋਈ ਫੇਮਸ ਹੋਵੇ ਜਿੱਥੇ ਸਪੈਸ਼ਲ ਡਿਸ਼ ਹੋਵੇ ਵੀ ਬਹੁਤ ਫੇਮਸ ਹੈ ਰੋਪੜ ਦੀ ਠੀਕ ਹੈ ਠੀਕ ਹੈ ਮੈਡਮ ਠੀਕ ਹੈ ਠੀਕ ਹੈ ਮੈਮ ਚਲੋ ਠੀਕ ਹੈ ਮੈਮ ਥੈਂਕ ਯੂ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ